ਹਾਂਜੀ ਸਾਡੇ ਸਕੂਲ ਦੇ ਵਿੱਚ ਲਾਈਬ੍ਰੇਰੀ ਹੈ ਲਾਈਬ੍ਰੇਰੀ ਬਹੁਤ ਸੋਹਣੀ ਬਣੀ ਹੋਈ ਹੈ ਉਸਦੇ ਤਿੰਨੇ ਪਾਸੇ ਹੀ ਅਲਮਾਰੀਆਂ ਲੱਗੀਆਂ ਹੋਈਆਂ ਹਨ ਅਲਮਾਰੀਆਂ ਵਿੱਚ ਜਿਹੜੀਆਂ ਪੜ੍ਹਾਈ ਵਾਲੀਆਂ ਕਿਤਾਬਾਂ ਵੀ ਪਈਆਂ ਹੋਈਆਂ ਹਨ ਅਤੇ ਕਹਾਣੀਆਂ ਵਾਲੀਆਂ ਕਿਤਾਬਾਂ ਵੀ ਪਈਆਂ ਹੋਈਆਂ ਧਾਰਮਿਕ ਗ੍ਰੰਥ ਵੀ ਪਏ ਹੋਏ ਹਨ ਧਾਰਮਿਕ ਕਿਤਾਬਾਂ ਵੀ ਪਈਆਂ ਹੋਈਆਂ ਹਨ ਰਸਾਲੇ ਅਖਬਾਰਾਂ ਜਿਹੜੀ ਘਰ ਅਖਬਾਰਾਂ ਰੋਜ਼ ਆਉਂਦੀ ਹੈ ਉਹ ਅਖਬਾਰ ਦਾ ਸਟੈਂਡ ਵੀ ਲੱਗਾ ਹੋਇਆ ਹੈ ਉਹਦੇ ਵਿੱਚ ਜੇਲ੍ਹ ਚਿੱਠੀਆਂ ਗੁਰਮਤਿ ਵਿਵੇਕ ਸੇਕ ਨੇ ਆਹਾ ਕਿਤਾਬਾਂ ਜਿਹੜੀਆਂ ਕਿ ਅੱਜ ਵੀ ਮੈਨੂੰ ਕੁਛ ਉਹਨਾਂ ਦੇ ਤਸਵੀਰਾਂ ਯਾਦ ਹਨ ਕਿ ਉਹਨਾਂ ਦੇ ਵਿੱਚ ਕੀ ਭਾਈ ਰਣਧੀਰ ਸਿੰਘ ਜੀ ਨੇ ਲਿਖਿਆ ਹੈ ਕਹਾਣੀਆਂ ਵਾਲੀਆਂ ਕਿਤਾਬਾਂ ਪੜ੍ਹੀਆਂ ਜਿਹਨਾਂ ਦੇ ਵੀ ਨਾਲ ਕਿ ਅਸੀਂ ਆਪਣੇ ਆਪ ਦੇ ਜ ਆਪਣੇ ਜੀਵਨ ਨੂੰ ਬਹੁਤ ਸਵਾਰ ਸਕਦੇ ਹਾਂ ਜੇਕਰ ਅਸੀਂ ਕਿਤਾਬਾਂ ਨਾਲ ਪਿਆਰ ਕਰਾਂਗੇ ਤਾਂ ਕਿਤਾਬਾਂ ਸਾਨੂੰ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ